ਸਤਿ ਸ਼੍ਰੀ ਅਕਾਲ ਸਰ ਸਰ ਸਤਿਗੁਰ ਟੈਕਸੀ ਸਟੈਂਡ ਤੋਂ ਬੋਲ ਰਹੇ ਜੀ ਸਰ ਮੈਂ ਪੁੱਛਣਾ ਸੀ ਮੈਂ ਪੰਦਰਾਂ ਮਈ ਨੂੰ ਆਪਣੇ ਅੰਮ੍ਰਿਤਸਰ ਏਅਰਪੋਰਟ ਜਾਣਾ ਚਾਹੁੰਦਾ ਜੀ ਅਤੇ ਉੱਥੋਂ ਮੇਰੀ ਫਲਾਈਟ ਹੈ ਜੀ ਸ਼ਾਮ ਚਾਰ ਵਜੇ ਸਰ ਇਸ ਲਈ ਪੁੱਛਣਾ ਚਾਹੁੰਦਾ ਵੀ ਕਿ ਤੁਸੀਂ ਚਾਰਜਿਸ ਕੀ ਕਰਦੇ ਆ ਇਹਦੇ ਲਈ ਅਤੇ ਆਪਣੇ ਕੋਲ ਕਿਹੜੀਆਂ ਕਿਹੜੀਆਂ ਗੱਡੀਆਂ ਹੈਗੀਆਂ ਜਿਹੜੀਆਂ ਤੁਸੀਂ ਮੁਹੱਈਆ ਕਰਵਾਉਣਾ ਚਾਹੁੰਨੇ ਆ ਮੇਰੇ ਨਾਲ ਮੇਰੇ ਹੋਰ ਦੋ ਦੋਸਤ ਵੀ ਹਨ ਅਤੇ ਇਸ ਲਈ ਸਾਡੇ ਕੋਲ ਅਟੈਚੀ ਵੀ ਬੈਗ ਹਨ ਛੇ ਦੇ ਕਰੀਬ ਬੈਗ ਹਨ ਇਸ ਲਈ ਅਗਰ ਵੱਡੀ ਗੱਡੀ ਜਿੱਦਾਂ ਅਨੋਵਾ ਜਾਂ ਆਰਟੀਕਾ ਵਗੈਰਾ ਹੈਗੀ ਆ ਤਾਂ ਉਹ ਮੈਨੂੰ ਦੱਸ ਸਕਦੇ ਆ ਤੁਸੀਂ ਉਹਦੀ ਉਪਲੱਬਧਤਾ ਹੈ ਉਸ ਦਿਨ ਵਾਸਤੇ ਜੀ ਅਤੇ ਇਸ ਤੋਂ ਇਲਾਵਾ ਸਰ ਇਹ ਵੀ ਪੁੱਛਣਾ ਸੀ ਕਿ ਮਤਲਬ ਜਿੱਦਾਂ ਕੋਈ ਹੋਰ ਸ਼ੇਰਿੰਗ ਬੇਸ 'ਤੇ ਵੀ ਅਸੀਂ ਜਾ ਸਕਦੇ ਕਿਸੇ ਨਾਲ ਜਿੱਦਾਂ ਵੱਡੀਆਂ ਇਸ ਤੋਂ ਵੀ ਵੱਡੀਆਂ ਗੱਡੀਆਂ ਟੈਂਪੂ ਟਰੈਵਰਸ ਵੀ ਹੁੰਦੀਆਂ ਜੇ ਕੋਈ ਤੁਹਾਡੀ ਉਸ ਦਿਨ ਵੀ ਸੇਮ ਸਮੇਂ 'ਤੇ ਕੋਈ ਹੈ ਗੱਡੀ ਤਾਂ ਤੁਸੀਂ ਮੈਨੂੰ ਉਸ ਬਾਰੇ ਜਾਣਕਾਰੀ ਦੇ ਦਿਓ ਔਰ ਇਹ ਵੀ ਮੈਨੂੰ ਦੱਸ ਦਿਓ ਜੀ ਕਿਰਪਾ ਕਰਕੇ ਵੀ ਜੇ ਅਲੱਗ ਅਸੀਂ ਜਾਣਾ ਤਿੰਨ ਦੋਸਤਾਂ ਨੇ ਉਹਦੇ ਅਲੱਗ ਚਾਰਜਿਸ ਹੋਣਗੇ ਜਾਂ ਕਿਸੇ ਨਾਲ ਸ਼ੇਅਰਿੰਗ ਬੇਸ 'ਤੇ ਜਾਣਾ ਤਾਂ ਉਹਦੇ ਵਿੱਚ ਕੁਛ ਕਟੌਤੀ ਸਾਡੀ ਜਿਹੜਾ ਅਸੀਂ ਤੁਹਾਨੂੰ ਭੁਗਤਾਨ ਕਰਨਾ ਉਹਦੇ ਵਿੱਚ ਕੁਛ ਕਟੌਤੀ ਹੋਵੇਗੀ ਜੀ ਧੰਨਵਾਦ ਜੀ